ਹਾਂਜੀ ਸਰ ਮੈਂ ਤੁਹਾਡੇ ਤੋਂ ਚਾਰਜਰ ਮੰਗਵਾਇਆ ਸੀਗਾ ਅਤੇ ਬਹੁਤ ਵਧੀਆ ਚਾਰਜਰ ਕਾਫੀ ਟਾਈਮ ਤੋਂ ਮੈਂ ਯੂਜ ਕਰਦਾ ਡੇਢ ਦੋ ਸਾਲ ਹੋ ਗਏ ਮੈਨੂੰ ਯੂਜ ਕਰਦੇ ਨੂੰ ਕਿ ਕਾਫੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਡੀਲ ਕਰਕੇ ਮੈਂ ਅਦਰਵਾਈਜ਼ ਮੈਂ ਕਿਤੇ ਹੋਰ ਵੀ ਟਰਾਈ ਕਰਦਾ ਪਿਆ ਸੀ ਐਮਾਜੋਨ ਤੋਂ ਵੀ ਹੋਰ ਕੋਈ ਔਨਲਾਈਨ ਵੀ ਟਰਾਈ ਕਰਦਾ ਪਿਆ ਸੀ ਬਟ ਮੈਂ ਹੁਣ ਤੁਹਾਡੇ ਤੋਂ ਮੰਗਵਾਇਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਦਾ ਡੀਲ ਕਰਕੇ ਲੱਗਿਆ ਮੈਨੂੰ ਅਤੇ ਅਦਰਵਾਈਜ਼ ਮੈਂ ਹੋਰ ਵੀ ਪ੍ਰੋਜੈਕਟ ਮੈਂ ਦੇਖਦਾ ਪਿਆ ਹੋਰ ਵੀ ਦੇਖਾਂਗੇ ਅਤੇ ਤੁਹਾਡੇ ਕੋਲ ਚਾਰਜਰ ਮੰਗਵਾਇਆ ਸੀ ਚਾਰਜਰ ਬਹੁਤ ਵਧੀਆ ਨਿਕਲਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਵਧੀਆ ਪ੍ਰੋਜੈਕਟ ਆ ਤੁਹਾਡਾ ਬਹੁਤ ਵਧੀਆ ਤੁਹਾਡੀ ਸਰਵਿਸ ਹੈ ਡਿਲੀਵਰੀ ਹੈ ਅਤੇ ਕਾਫੀ ਟਾਈਮ ਤੋਂ ਮੈਂ ਕੋਈ ਗੱਲ ਨਹੀਂ ਮੈਂ ਹੋਰ ਦੇਖਾਂਗਾ ਜੀ ਉਸ ਤੋਂ ਇਲਾਵਾ ਕੋਈ ਉਹ ਨਹੀਂ ਹੈਗਾ ਪ੍ਰੋਬਲਮ ਕੋਈ ਨਹੀਂ ਹੈਗੀ ਅਤੇ ਮੈਂ ਤੁਹਾਡੇ ਕੋਲ ਹੋਰ ਵੀ ਡੀਲ ਕਰਨਾ ਚਾਹੁੰਦਾ ਵਾਂ ਅਤੇ ਆਪਾਂ ਜਲਦੀ ਤੋਂ ਜਲਦ ਮੈਂ ਡੀਲ ਕਰਾਂਗਾ ਤੁਹਾਡੇ ਨਾਲ ਅਤੇ ਕਾਫੀ ਟਾਈਮ ਤੋਂ ਪ੍ਰੋਜੈਕਟ ਮੈਂ ਹੋਰ ਦੇਖ ਰਿਹਾ ਵਾਂ ਤੁਹਾਡੇ ਉਸ ਤੋਂ ਇਲਾਵਾ ਕਾਫੀ ਟਾਈਮ ਤੋਂ ਮੈਂ ਫਰੈਂਡ ਨੂੰ ਵੀ ਸਾਰਿਆਂ ਨੂੰ ਕਿਹਾ ਸਰਕਲ 'ਤੇ ਆਪਣੇ ਹੈਗੇ ਜਿੰਨੇ ਵੀ ਮੈਂ ਕਿਹਾ ਉਹਨਾਂ ਨੂੰ ਕਿਹਾ ਹੋਇਆ ਵਾ